ਹਾਂਜੀ ਮੈਂ ਆਪਣੇ ਘਰ ਵਿੱਚ ਹੀ ਖਾਣਾ ਸਾਰਿਆਂ ਦੇ ਨਾਲ ਇਕੱਠੇ ਬਹਿ ਕੇ ਹੀ ਖਾਂਦੇ ਹਾਂ ਘਰ ਵਿੱਚ ਅਸੀਂ ਇੱਕ ਟਾਈਮ ਦਾ ਖਾਣਾ ਇਕੱਠੇ ਬੈਠ ਕੇ ਜ਼ਰੂਰ ਖਾਂਦੇ ਹਾਂ ਜਿਸ ਨਾਲ ਆਪਸ ਦੇ ਵਿੱਚ ਪਿਆਰ ਮਾਣ ਸਤਿਕਾਰ ਵੱਧਦਾ ਹੈ ਅਸੀਂ ਆਪਸੀ ਗੱਲਾਂ ਨੂੰ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਹਨ ਜਿਸ ਦੇ ਨਾਲ ਕਈ ਮਸਲਿਆਂ ਦੇ ਹੱਲ ਵੀ ਨਿਕਲ ਆਉਂਦੇ ਹਨ ਅਸੀਂ ਆਪਣੇ ਘਰ ਦੇ ਵਿੱਚ ਕਈ ਵਾਰ ਰਿਸ਼ਤੇਦਾਰਾਂ ਨੂੰ ਵੀ ਖਾਣੇ 'ਤੇ ਬੁਲਾਉਂਦੇ ਹਾਂ ਜਿਸ ਨਾਲ ਆਪਸੀ ਪਿਆਰ ਵਿੱਚ ਵਾਧਾ ਹੁੰਦਾ ਹੈ ਅਤੇ ਸਤਿਕਾਰ ਵੀ ਮਿਲਦਾ ਹੈ ਤੁਹਾਡੇ ਖਾਣੇ ਦੀ ਤਾਰੀਫ ਵੀ ਕੀਤੀ ਜਾਂਦੀ ਹੈ ਜਿਸ ਨਾਲ ਕਿ ਬਹੁਤ ਖੁਸ਼ੀ ਮਿਲਦੀ ਹੈ ਅਸੀਂ ਵਿਆਹ ਸ਼ਾਦੀ ਦੇ ਸਮਾਗਮਾਂ ਵਿੱਚ ਵੀ ਇਕੱਠੇ ਖਾਣਾ ਖਾਂਦੇ ਹਾਂ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਹੈ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੁਹਾਨੂੰ ਤੁਹਾਡੀ ਕਮੀਆਂ ਦੇ ਬਾਰੇ ਵੀ ਪਤਾ ਚੱਲਦਾ ਹੈ ਜਿਸ ਨੂੰ ਕਿ ਸੁਧਿਆਰਾ ਸੁਧਾਰਿਆ ਜਾਣਾ ਚਾਹੀਦਾ ਹੈ ਤੁਸੀਂ ਇੱਕ ਸਮਝਦਾਰ ਇਨਸਾਨ ਦੇ ਵਜੋਂ ਵੀ ਉਭਰਦੇ ਹੋ